ਲੋਰੀ ਦਾ ਮਤਲਬ ਹੁੰਦਾ ਹੈ ਸ਼ਾਂਤ ਕਰਨ ਅਤੇ ਸਕੂਨ ਦੇਣਾ ਲੋਰੀ ਉਹ ਹੈ ਜੋ ਮਾਵਾਂ ਦਾਦੀਆਂ ਨਾਨੀਆਂ ਛੋਟੇ ਬੱਚਿਆਂ ਨੂੰ ਸਲਾਉਣ ਲਈ ਗਾਉਂਦੀਆਂ ਹਨ ਇਹ ਧੀਮੀ ਅਤੇ ਮਿੱਠੀ ਆਵਾਜ਼ ਵਿੱਚ ਗਾਈਆਂ ਜਾਂਦੀਆਂ ਹਨ ਲੋਰੀ ਅਲੱਗ ਅਲੱਗ ਵਿਸ਼ੇ ਦੀ ਹੁੰਦੀ ਹੈ ਧਾਰਮਿਕ ਸੰਮੋਧਿਕ ਵਿਅੰਗਮਿਕ ਅਤੇ ਪਰੰਪਰਿਕ ਹੁੰਦੀਆਂ ਹਨ ਕੁਝ ਲੋਰੀਆਂ ਪਰੀਆਂ ਦੇ ਦੇਸ਼ ਤਾਰਾ ਮੰਡਲ ਅਤੇ ਜੰਗਲੀ ਜਾਨਵਰ ਦੇ ਵਿਸ਼ੇ ਵਿੱਚ ਵੀ ਹੁੰਦੀਆਂ ਹਨ ਲੋਰੀਆਂ ਨਾਨੀ ਦਾਦੀ ਮਾਵਾਂ ਦੁਆਰਾ ਗਾਈਆ ਜਾਂਦੀਆਂ ਹਨ ਅਤੇ ਹੋਰ ਸਭ ਵੀ ਇਸਨੂੰ ਗਾ ਸਕਦੇ ਹਨ ਮੈਨੂੰ ਵੀ ਮੇਰੀ ਨਾਨੀ ਲੋਰੀ ਗਾ ਕੇ ਹੀ ਸੁਲਾਉਂਦੀ ਸੀ ਸੁਲਾਉਂਦੀ ਸੀ ਅਤੇ ਮੇਰੇ ਹੁਣ ਇੱਕ ਬੇਟੀ ਹੈ ਅਤੇ ਉਹ ਵੀ ਇਹ ਹੀ ਲੋਰੀ ਸੁਣ ਕੇ ਸੌਂਦੀ ਹੈ ਮੇਰੀ ਫੇਵਰੇਟ ਲੋਰੀ ਹੈ

ਇਹ ਲੋਰੀ ਮੇਰੀ ਫੇਵਰੇਟ ਸੀ ਜੋ ਕਿ ਮੇਰੇ ਨਾਨੀ ਜੀ ਮੈਨੂੰ ਸੁਣਾਉਂਦੇ ਸੀ ਅਤੇ ਹੁਣ ਮੇਰੀ ਬੇਟੀ ਵੀ ਇਹ ਲੋਰੀ ਸੁਣ ਕੇ ਸੌਂਦੀ ਹੈ ਅਤੇ ਉਸਨੂੰ ਆਦਤ ਹੋਗੀ ਇਹ ਲੋਰੀ ਸੁਣਨ ਦੀ ਧੰਨਵਾਦ